ਸਤਿ ਸ਼੍ਰੀ ਅਕਾਲ ਜੀ ਮੈਂ ਜ਼ਿਆਦਾਤਰ ਆਨਲਾਈਨ ਸ਼ੋਪਿੰਗ ਹੀ ਕਰਦਾ ਹਾਂ ਮੈਂ ਪਿਛਲੇ ਹਫਤੇ ਹੀ ਮੀਸ਼ੋ ਤੋਂ ਕੁਝ ਆਨਲਾਈਨ ਸ਼ਰਟਾਂ ਮੰਗਵਾਈਆਂ ਸਨ ਇਹ ਸ਼ਰਟਾਂ ਬਹੁਤ ਹੀ ਵਧੀਆ ਕੁਆਲਿਟੀ ਦੀਆਂ ਹਨ ਅਤੇ ਇਹਨਾਂ ਸ਼ਰਟਾਂ ਦਾ ਰੰਗ ਵੀ ਬਹੁਤ ਵਧੀਆ ਹੈ ਆਨਲਾਈਨ ਸ਼ੋਪਿੰਗ ਕਰਨ ਦੇ ਹੋਰ ਕਈ ਪਲੈਟਫੋਰਮ ਹੁੰਦੇ ਹਨ ਜਿਵੇਂ ਕਿ ਐਮਾਜ਼ੋਨ ਫਲਿਪਕਾਰਟ ਮੀਸ਼ੋ ਮਿੰਤਰਾ ਆਦਿ ਪਰ ਮੈਂ ਜ਼ਿਆਦਾਤਰ ਸ਼ੋਪਿੰਗ ਮੀਸ਼ੋ ਤੋਂ ਹੀ ਕਰਦਾ ਹਾਂ ਕਿਉਂਕਿ ਇਹ ਪਲੇਟਫਾਰਮ ਉੱਤੇ ਬਹੁਤ ਹੀ ਵਧੀਆ ਸਮਾਨ ਮਿਲਦਾ ਹੈ ਅਤੇ ਇਹਨਾਂ ਦੀ ਸਰਵਿਸ ਵੀ ਬਹੁਤ ਵਧੀਆ ਹੈ ਇਸ ਉੱਤੇ ਸਾਨੂੰ ਕਾਫੀ ਡਿਸਕਾਊਂਟ ਵੀ ਮਿਲ ਜਾਂਦਾ ਹੈ ਅਤੇ ਆਨਲਾਈਨ ਸ਼ਾਪਿੰਗ ਕਰਨ ਨਾਲ ਸਾਨੂੰ ਬਾਜ਼ਾਰ ਨਾਲੋਂ ਸਸਤੇ ਅਤੇ ਵਧੀਆ ਕੁਆਲਿਟੀ ਅਤੇ ਸਾਮਾਨ ਮਿਲ ਜਾਂਦਾ ਹੈ ਇਸ ਵਿੱਚ ਸਾਨੂੰ ਕੈਸ਼ ਔਣ ਡਿਲੀਵਰੀ ਦੀ ਆਪਸ਼ਨ ਵੀ ਮਿਲਦੀ ਹੈ ਜੇਕਰ ਕੋਈ ਰੋਂਗ ਪ੍ਰੋਡਕਟ ਜਾਂ ਖਰਾਬ ਸਮਾਨ ਆ ਜਾਂਦਾ ਹੈ ਤਾਂ ਕੰਪਨੀ ਵੱਲੋਂ ਪੂਰੀ ਸੁਵਿਧਾ ਮਿਲਦੀ ਹੈ ਅਤੇ ਤੁਹਾਡੇ ਪੈਸੇ ਵੀ ਵਾਪਿਸ ਹੋ ਜਾਂਦੇ ਹਨ ਮੈਂ ਪਿਛਲੇ ਦੋ ਤਿੰਨ ਸਾਲਾਂ ਤੋਂ ਆਨਲਾਈਨ ਸਾਮਾਨ ਅਲੱਗ ਅਲੱਗ ਆਨਲਾਈਨ ਵੈਬਸਾਈਟਾਂ ਤੋਂ ਮੰਗਵਾ ਰਿਹਾ ਹਾਂ ਜਿਸ ਕਾਰਨ ਮੈਨੂੰ ਕੁਝ ਆਨਲਾਈਨ ਪਲੇਟਫਾਰਮਾਂ ਤੋਂ ਵਧੀਆ ਆਫਰ ਵੀ ਮਿਲ ਜਾਂਦੇ ਹਨ ਆਨਲਾਈਨ ਸ਼ਾਪਿੰਗ ਕਰਨ ਦਾ ਮੇਰਾ ਇਹ ਤਜਰਬਾ ਬਹੁਤ ਹੀ ਵਧੀਆ ਰਿਹਾ ਹੈ